ਹੈਲੋ ਵਧੀਆ ਭੈਣ ਜੀ ਤੁਸੀਂ ਦੱਸੋ ਕੀ ਹਾਲ ਚਾਲ ਨੇ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂ ਬਹੁਤ ਵਧੀਆ ਦੱਸ ਕੇ ਗਏ ਨੇ ਗਲੋਬਲ ਵਾਰਮਿੰਗ ਵੀ ਜਿਹੜੀ ਵੱਧ ਰਹੀ ਹੈ ਇਹ ਕੁਛ ਤਾਂ ਉਹ ਐਂਏ ਦੱਸ ਕੇ ਗਏ ਨੇ ਵੀ ਕੁ ਕੁਛ ਕਾਰਨ ਤਾਂ ਇਹ ਆਪਣੇ ਕਰਕੇ ਹੀ ਨੇ ਹੈ ਨਾ ਆਪਾਂ ਪ ਦਰੱਖਤ ਕੱਟੀ ਜਾਂਦੇ ਹਾਂ ਫਾਲਤੂ ਦੇ ਘਰ ਬਣਾਉਣ ਲਈ ਯੇ ਵੋ ਹੈ ਨਾ ਸੜਕਾਂ ਬਣਾਉਣ ਲਈ ਸਰਕਾਰ ਵੀ ਪਟਵਾ ਹੀ ਰਹੀ ਹੈ ਵੈਸੇ ਤਾਂ ਅਤੇ ਬਾਕੀ ਵੀ ਇਹਦੇ ਪ੍ਰਭਾਵ ਬਹੁਤ ਜ਼ਿਆਦਾ ਖੇਤੀਬਾੜੀ 'ਤੇ ਗਲਤ ਪੈ ਰਹੇ ਨੇ ਜਿਵੇਂ ਹੁਣ ਜਦੋਂ ਆਪਾਂ ਨੂੰ ਮੀਂਹ ਦੀ ਲੋੜ ਹੁੰਦੀ ਹੈ ਉਦੋਂ ਮੀਂਹ ਨਹੀਂ ਪੈਂਦਾ ਅਤੇ ਜਦੋਂ ਆਪਾਂ ਨੂੰ ਕੀ ਕਹਿ ਸਕਦੇ ਹਾਂ ਆਪਾਂ ਜਦੋਂ ਵੀ ਕੋਈ ਵੀ ਆਪਾਂ ਨੂੰ ਜਿਸ ਚੀਜ਼ ਦੀ ਲੋੜ ਹੁੰਦੀ ਉਹ ਹੁੰਦਾ ਨਹੀਂ ਹੈਗਾ ਹੈ ਨਾ ਹਾਂ ਹਾਂ ਹਾਂ ਸਹੀ ਗੱਲ ਹੈ ਹਾਂ ਹਾਂ ਇਹ ਹਾਂ ਇਹੀ ਦੱਸਦੇ ਸੀਗੇ ਇਹੀ ਦੱਸਦੇ ਸੀ ਅਤੇ ਫਿਰ ਆਪਾਂ ਨੂੰ ਉਹੀ ਆਰਟੀਫਿਸ਼ਅਲ ਤਰੀਕੇ ਨਾਲ ਸਿੰਚਾਈ ਕਰਨੀ ਪੈਂਦੀ ਹੈ ਆਪਣੇ ਖਰਚੇ ਵੱਧ ਗਏ ਨੇ ਅਤੇ ਆਪਣੀ ਵੀ ਫਿਰ ਉਹ ਮਿੱਟੀ ਵੀ ਓਨੀ ਉਪਜਾਊ ਨਹੀਂ ਰਹਿੰਦੀ ਮੀਂਹ ਦਾ ਪਾਣੀ ਤਾਂ ਕਿੰਨਾ ਵਧੀਆ ਹੁੰਦਾ ਹੈ ਨਾ ਉਹਦੇ ਨਾਲ ਥੋੜ੍ਹਾ ਫਸਲ ਵੀ ਵਧੀਆ ਹੋ ਜਾਂਦੀ ਹੈ ਅਤੇ ਇਹੀ ਕੁਛ ਹੋ ਰਿਹਾ ਸੀਗਾ ਦੱਸ ਰਹੇ ਸੀਗੇ ਬਹੁਤ ਵਧੀਆ ਦੱਸ ਕੇ ਗਏ ਨੇ ਵੈਸੇ ਆਪਾਂ ਨੂੰ ਇਹ 'ਤੇ ਧਿਆਨ ਦੇਣ ਦੀ ਲੋੜ ਹੈਗੀ ਹੈ ਵੀ ਪੀ ਏ ਯੂ ਵਧੀਆ ਦੱਸ ਕੇ ਗਈ ਆ ਐਗਰੀਕਲਚਰ 'ਤੇ ਪ੍ਰਭਾਵ ਨਾ ਆਪਾਂ ਮਾੜੇ ਜੇ ਆਪ ਹੀ ਗਲਤ ਪਾਉਣੇ ਸ਼ੁਰੂ ਕਰ ਦਿੱਤੇ ਗਲੋਬਲ ਵਾਰਮਿੰਗ ਵਧਾਉਣ ਵਧਣ ਦੇ ਕਰਕੇ ਚਲੋ ਹਾਂ ਹੋਰ

ਅੱਛਾ ਹਾਂ ਹਾਂ ਵਧੀਆ ਦੱਸ ਕੇ ਗਏ ਨੇ ਹਾਂਜੀ ਹਾਂ ਠੀਕ ਹੈ ਭੈਣ ਜੀ ਓਕੇ ਹਾਂਜੀ ਹਾਂਜੀ ਹਾਂਜੀ ਭੈਣ ਜੀ ਠੀਕ ਹੈ ਓਕੇ